ਮੈਂ ਪਟਿਆਲੇ ਵਿੱਚ ਰਹਿੰਦੀ ਹਾਂ ਜਿਵੇਂ ਕਿ ਸਾਡੇ ਕਿਤੇ ਰਿਸ਼ਤੇਦਾਰਾਂ ਨੇ ਪਟਿਆਲੇ ਵਿੱਚ ਆਉਣਾ ਹੋਵੇ ਤਾਂ ਮੈਂ ਗੂਗਲ ਮੈਪ ਰਾਹੀਂ ਪਟਿਆਲੇ ਦੀ ਲੋਕੇਸ਼ਨ ਉਨ੍ਹਾਂ ਨੂੰ ਸੈਂਡ ਕਰ ਦਿੰਦੀ ਹਾਂ ਤਾਂ ਕਰਕੇ ਉਹ ਆਸਾਨੀ ਵਿੱਚ ਪਟਿਆਲੇ ਵਿੱਚ ਆ ਜਾਂਦੇ ਨੇ ਅਤੇ ਜਿਵੇਂ ਕਿ ਮੈਨੂੰ ਕਿਤੇ ਪਟਿਆਲੇ ਦੇ ਨਜ਼ਦੀਕੀ ਨਜ਼ਦੀਕ ਵੀ ਕਿਤੇ ਜਾਣਾ ਹੋਵੇ ਤਾਂ ਮੈਂ ਗੂਗਲ ਮੈਪ ਲਗਾ ਕੇ ਉੱਥੇ ਉਸ ਲੋਕੇਸ਼ਨ 'ਤੇ ਪਹੁੰਚ ਜਾਂਦੀ ਹਾਂ ਜਾਂ ਮੈਨੂੰ ਕਿਸੇ ਸਟੱਡੀ ਰਿਲੇਟਿਡ ਕੁਛ ਵੀ ਜਾਣਕਾਰੀ ਲੈਣੀ ਹੋਵੇ ਤਾਂ ਮੈਂ ਗੂਗਲ ਤੋਂ ਆਸਾਨੀ ਨਾਲ ਉਸ ਦੀ ਜਾਣਕਾਰੀ ਲੈ ਲੈਂਦੀ ਹਾਂ ਜਿਮ ਗੂਗਲ ਨੇ ਬਹੁਤ ਹੀ ਮੇਰੀ ਸਹਾਇਤਾ ਕੀਤੀ ਹੈ ਜਿਵੇਂ ਕਿ ਸਟੱਡੀ ਵਿੱਚ ਜਾਂ ਕੋਈ ਰੈਸੀਪੀ ਵਗੈਰਾ ਵਿੱਚ ਕੁਛ ਵੀ ਹੋਵੇ ਤਾਂ ਮੈਂ ਗੂਗਲ ਦੀ ਹੀ ਜਾਣਕਾਰੀ ਲੈਂਦੀ ਹਾਂ ਤਾਂ ਕਰਕੇ ਗੂਗਲ ਨੇ ਬਹੁਤ ਹੀ ਵਧੀਆ ਅੱਛੇ ਐਕਸਪਲੇਨੇਸ਼ਨ ਨਾਲ ਦੱਸ ਦਿੰਦਾ ਹੈ ਇਸ ਕਰਕੇ ਮੈਨੂੰ ਗੂਗਲ ਦੀ ਹੀ ਗੂਗਲ ਤੋਂ ਹੀ ਮੈਨੂੰ ਬਹੁਤ ਜ਼ਿਆਦਾ ਬੈਨੀਫਿਟਸ ਵੀ ਹੁੰਦੇ ਨੇਗੇ